ਮੈਂ ਆਪਣੀ ਡਰਾਇੰਗ ਵਿੱਚ ਗਤੀਸ਼ੀਲਤਾ ਨੂੰ ਵੱਖ ਵੱਖ ਤਰੀਕਿਆਂ ਨਾਲ ਸ਼ਾਮਿਲ ਕਰਦਾ ਹਾਂ ਜਿਸ ਵਿੱਚੋਂ ਇੱਕ ਤਰੀਕਾ ਹੈ ਪੈਨ ਦੁਆਰਾ ਪੈਨਸਲ ਦੁਆਰਾ ਵੱਖ ਵੱਖ ਸਥਿਰ ਚਿੱਤਰਾਂ ਨੂੰ ਇੱਕ ਵੱਖ ਵੱਖ ਪੇਜਾਂ ਉੱਤੇ ਬਣਾਇਆ ਜਾਵੇ ਅਤੇ ਜਦੋਂ ਆਪਾਂ ਉਹਨਾਂ ਪੇਜਾਂ ਨੂੰ ਮੂਵ ਕਰਦੇ ਹਾਂ ਤਾਂ ਉਹ ਇੱਕ ਮੋਸ਼ਨ ਚਿੱਤਰ ਵਾਂਗ ਦਿਖਾਈ ਦਿੰਦਾ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਦਾਂ ਚਿੱਤਰ ਚੱਲ ਰਹੇ ਹਨ ਇਸ ਨਾਲ ਮੋਸ਼ਨ ਨੂੰ ਸਫਲਤਾਪੂਰਵਕ ਕੈਪਚਰ ਕੀਤਾ ਜਾ ਸਕਦਾ ਹੈ ਇਹ ਇੱਕ ਬਹੁਤ ਹੀ ਆਸਾਨ ਅਤੇ ਵਧੀਆ ਤਰੀਕਾ ਹੈ ਜਿਸ ਨਾਲ ਸਥਿਰ ਚਿੱਤਰ ਨੂੰ ਮੋਸ਼ਨ ਚਿੱਤਰ ਵਿੱਚ ਸਫਲਤਾਪੂਰਵਕ ਬਦਲਿਆ ਜਾ ਸਕਦਾ ਹੈ ਕੈਪਚਰ ਕੀਤਾ ਜਾ ਸਕਦਾ ਹੈ ਧੰਨਵਾਦ